ਲੋਹੜੀ ਪੋਹ ਮਹੀਨੇ ਦਾ ਪ੍ਰਸਿੱਧ ਤਿਉਹਾਰ ਹੈ ਇਹ ਪੋਹ ਮਹੀਨੇ ਦੇ ਅਖੀਰਲੀ ਰਾਤ ਨੂੰ ਮਨਾਇਆ ਜਾਂਦਾ ਹੈ ਲੋਹੜੀ ਦਾ ਤਿਉਹਾਰ ਫ਼ਸਲਾਂ ਦੀ ਵਾਢੀ ਦਾ ਪ੍ਰਤੀਕ ਹੈ ਲੋਹੜੀ ਦੇ ਤਿਉਹਾਰ ਨਾਲ ਜੁੜੀਆਂ ਕਈ ਕਹਾਣੀਆਂ ਹਨ ਪਰ ਲੋਹੜੀ ਨਾਲ ਜੁੜੀ ਸਭ ਤੋਂ ਵਧੇਰੇ ਲੋਕ ਕਥਾ ਦੁੱਲਾ ਭੱਟੀ ਦੀ ਹੈ ਲੋਹੜੀ ਵਾਲੇ ਦਿਨ ਜਿੱਥੇ ਪਹਿਲਾਂ ਤਾਂ ਪੁੱਤਰਾਂ ਅਤੇ ਨਵ ਵਿਆਹੇ ਜੋੜੇ ਦੀ ਲੋਹੜੀ ਪਾਈ ਜਾਂਦੀ ਆ ਉੱਥੇ ਹੀ ਹੁਣ ਧੀਆਂ ਦੀ ਲੋਹੜੀ ਵੀ ਬੜੇ ਧੂਮ ਧਾਮ ਨਾਲ ਮਨਾਈ ਜਾਂਦੀ ਹੈ ਇਸ ਦਿਨ ਸਾਰੇ ਦੋਸਤ ਰਿਸ਼ਤੇਦਾਰ ਪਰਿਵਾਰ ਧੂਣੀ ਬਾਲਦੇ ਹਨ ਅਤੇ ਭੰਗੜਾ ਪਾਉਂਦੇ ਹਨ